ਮੈਂ ਤੁਹਾਡੀ ਐਪ ਤੋਂ ਇੱਕ ਘੜੀ ਦਾ ਔਡਰ ਕੀਤਾ ਸੀ ਪਰ ਤੁਹਾਡੇ ਆਰਡਰ ਆਉਣ ਤੋਂ ਪਹਿਲਾਂ ਹੀ ਮੇਰੇ ਦੋਸਤ ਨੇ ਮੈਨੂੰ ਇੱਕ ਘੜੀ ਗਿਫ਼ਟ ਵਿੱਚ ਦੇ ਦਿੱਤੀ ਸੀ ਪਰ ਹੁਣ ਮੈਂ ਉਹ ਘੜੀ ਵਾਪਿਸ ਨਹੀਂ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ ਅਤੇ ਤੁਹਾਨੂੰ ਰਿਫੰਡ ਵਾਪਿਸ ਕਰਨਾ ਚਾਹੁੰਦਾ ਹਾਂ ਅਤੇ ਆਪਣੇ ਪੈਸੇ ਵਾਪਿਸ ਰਿਫੰਡ ਕਰਨ ਪ੍ਰਾਪਤ ਕਰਨਾ ਚਾਹੁੰਦਾ ਹਾਂ